ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਨਸੀ ਹੈ ਮੈਂ ਭਾਰਤੀ ਰੇਲਵੇ ਦੀ ਆਈ ਆਰ ਸੀ ਟੀ ਸੀ ਵੈੱਬਸਾਈਟ ਤੋਂ ਦਿੱਲੀ ਜਾਣ ਲਈ ਗੱਡੀ ਨੰਬਰ ਇੱਕ ਦੋ ਸਿਫਰ ਦੋ ਨੌ ਸਵਰਨ ਸ਼ਤਾਬਦੀ ਐਕਸਪ੍ਰੈਸ ਦੇ ਵਿੱਚ ਟਿਕਟ ਬੁੱਕ ਕਰਵਾਈ ਸੀ ਮੇਰਾ ਪੀ ਐਨ ਆਰ ਨੰਬਰ ਹੈ ਦੋ ਚਾਰ ਦੋ ਸਿਫਰ ਸੱਤ ਅੱਠ ਸੱਤ ਅੱਠ ਨੌ ਦੋ ਅਤੇ ਮੇਰੀ ਉਪਭੋਗਤਾ ਆਈ ਡੀ ਹੈ ਗੌਤਮ ਮਾਨਸੀ ਸਿਫਰ ਸਿਫਰ ਇੱਕ ਚਾਰ ਸਿਫਰ ਇੱਕ ਦਰਅਸਲ ਮੈਂ ਪੱਚੀ ਫਰਵਰੀ ਦੋ ਹਜ਼ਾਰ ਪੱਚੀ ਨੂੰ ਸਵੇਰੇ ਸੱਤ ਵਜੇ ਇਸ ਗੱਡੀ ਤੋਂ ਜਲੰਧਰ ਤੋਂ ਦਿੱਲੀ ਜਾਣਾ ਸੀ ਪਰ ਘਰ ਵਿੱਚ ਸਦੱਸ ਦੇ ਬਿਮਾਰ ਹੋਣ ਕਾਰਨ ਮੈਨੂੰ ਆਪਣੀ ਯਾਤਰਾ ਯੋਜਨਾਵਾਂ ਬਦਲਣੀਆਂ ਪੈ ਰਹੀਆਂ ਹਨ ਮੈਂ ਆਪਣੇ ਤੌਰ ਤੋਂ ਆਈ ਆਰ ਸੀ ਟੀ ਸੀ ਦੀ ਆਨਲਾਈਨ ਵੈਬਸਾਈਟ 'ਤੇ ਆਪਣੀ ਟਿਕਟ ਰੱਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਵਾਰ ਵਾਰ ਕੋਸ਼ਿਸ਼ ਅਸਫਲ ਰਹੀ ਆਈ ਆਰ ਸੀ ਟੀ ਸੀ ਦੀ ਗਾਹਕ ਸੇਵਾ ਕੇਂਦਰ ਤੋਂ ਮੈਨੂੰ ਅਨੁਰੋਧ ਹੈ ਕਿ ਮੈਨੂੰ ਦੱਸਿਆ ਜਾਵੇ ਕਿ ਮੈਂ ਕਿਵੇਂ ਆਪਣੀ ਉਪਭੋਗਤਾ ਆਈ ਡੀ ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੀ ਰੇਲ ਟਿਕਟ ਨੂੰ ਰੱਦ ਕਰਵਾ ਸਕਦੀ ਹਾਂ ਤੁਹਾਡੇ ਵੱਲੋਂ ਦਿੱਤੀ ਗਈ ਹਰ ਸਹਾਇਤਾ ਲਈ ਮੈਂ ਬਹੁਤ ਆਭਾਰੀ ਹੋਵਾਂਗੀ ਧੰਨਵਾਦ